ਦੌੜ ਦੀ ਤਿਆਰੀ ਕਰਨ ਵੇਲੇ ਮੈਂ ਸਵੇਰੇ ਉੱਠਦਾ ਹਾਂ ਅਤੇ ਜੋਗਿੰਗ ਲਈ ਜਾਂਦਾ ਹਾਂ ਅਤੇ ਸੁਬਾਹ ਉੱਠ ਕੇ ਮੈਂ ਭਿੱਜੇ ਹੋਏ ਛੋਲੇ ਖਾਂਦਾ ਅਤੇ ਭੱਜਣ ਜਾਂਦਾ ਉਸ ਤੋਂ ਬਾਅਦ ਆ ਕੇ ਬਨਾਨਾ ਸ਼ੇਕ ਅਤੇ ਪਨੀਰ ਖਾਂਦਾ ਦਿਨ ਵਿੱਚ ਮੈਂ ਹਰੀਆਂ ਸਬਜ਼ੀਆਂ ਖਾਂਦਾ ਅਤੇ ਤਲੀਆਂ ਹੋਈਆਂ ਚੀਜ਼ਾਂ ਤੋਂ ਦੂਰ ਰਹਿੰਦਾ ਅਤੇ ਆਪਣਾ ਹਰੀਆਂ ਸਬਜ਼ੀਆਂ ਅਤੇ ਉਨ੍ਹਾਂ ਨਾਲ਼ ਆਪਣੇ ਸਰੀਰ ਨੂੰ ਤੰਦਰੁਸਤ ਰੱਖਦਾ ਅਤੇ ਐਕਸਸ਼ਾਈਜ਼ ਕਰਦਾ ਹਰ ਦਿਨ ਵਿੱਚ ਮੈਂ ਛੋਲੇ ਨਾਲ਼ ਹੀ ਰੱਖਦਾ ਅਤੇ ਪਾਣੀ ਵੱਧ ਤੋਂ ਵੱਧ ਪਾਣੀ ਅਤੇ ਹਰੀਆਂ ਸਬਜ਼ੀਆਂ ਹੀ ਖਾਂਦਾ